ਪਿਛਲੇ ਹਫ਼ਤੇ ਦੀ ਗੱਲ ਹੈ ਸਾਡੀ ਸਾਡੇ ਗੁਆਢੀਆਂ ਨਾਲ ਵੱਟ ਪਿੱਛੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਘਰ ਦੇ ਸਿਆਣਿਆਂ ਨੇ ਸਾਨੂੰ ਸਮਝਾਇਆ ਕਿ ਇੱਦਾਂ ਨਾ ਕਰੋ ਕਿ ਆਪਣੀ ਲੜਾਈ ਝਗੜਾ ਨਾ ਕਰੋ ਆਪਣੀ ਵੱਟਾਂ ਸਾਝੀ ਨਾ ਕਰੋ ਅਲੱਗ ਅਲੱਗ ਪਾ ਲਉ ਜੋ ਕਿ ਅਸੀਂ ਨਹੀਂ ਸਮਜੇ ਫਿਰ ਸਾਡਾ ਝਗੜਾ ਸਾਡੀ ਪੰਚਾਇਤ ਪਿੰਡ ਦੀ ਪੰਚਾਇਤ ਵਿੱਚ ਗਿਆ ਪਿੰਡ ਦੀ ਪੰਚਾਇਤ ਨੇ ਵੀ ਸਾਨੂੰ ਸਮਝਾਇਆ ਕਿ ਕਾ ਅੱਗੇ ਤੋਂ ਆਪਣਾ ਅਲੱਗ ਅਲੱਗ ਵੱਟ ਪਾ ਕੇ ਆਪਣਾ ਕਾਰਵ ਕੰਮ ਕਰੋ ਤਾਂ ਫਿਰ ਵੀ ਅਸੀਂ ਸਾਡੇ ਦੋਨੋਂ ਪਰਿਵਾਰ ਆ ਆਪਸ ਵਿੱਚ ਨਹੀਂ ਸਮਝੇ ਅਤੇ ਸਾਡਾ ਕੇਸ ਹੁਣ ਕੋਰਟ ਵਿੱਚ ਚਲਦਾ ਹੈ ਅਤੇ ਉਹ ਅੱਗੇ ਕੇਸ ਵਾਈਜ ਕੇਸ ਚੱਲੀ ਜਾਂਦਾ ਹੈ